ਭਾਰਤੀ ਭਾਰਤੀ ਫਿਲਮਾਂ ਅਤੇ ਭਾਰਤੀ ਸੰਗੀਤ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਭਾਰਤੀ ਫਿਲਮਾਂ ਅਤੇ ਭਾਰਤੀ ਸੰਗੀਤ ਖ਼ਾਸ ਕਰਕੇ ਪੰਜਾਬੀ ਸਿ ਸੰਗੀਤ ਦੁਨੀਆ ਭਰ ਦੇ ਵਿੱਚ ਛਾਇਆ ਹੋਇਆ ਹੈ ਵੱਖ ਵੱਖ ਦੇਸ਼ਾਂ ਵਿੱਚ ਤੁਸੀਂ ਭਾਰਤੀ ਫਿਲਮਾਂ ਅਤੇ ਭਾਰਤੀ ਸੰਗੀਤ ਦੀਆਂ ਜਾਂ ਤੁਸੀਂ ਕਹਿ ਸਕਦੇ ਹੋ ਕਿ ਪੰਜਾਬੀ ਸੰਗੀਤ ਦੇ ਸਰੋਤੇ ਤੁਸੀਂ ਦੇਖ ਸਕਦੇ ਹੋ ਅਤੇ ਆਪਾਂ ਕਈ ਵਾਰੀ ਔਨਲਾਈਨ ਫੇਸਬੁੱਕ ਵਗੈਰਾ 'ਤੇ ਦੇਖਦੇ ਹਾਂ ਕਿ ਲੋਕ ਭਾਰਤੀ ਸੰਗੀਤ ਦੇ ਉੱਪਰ ਬਹੁਤ ਖੁਸ਼ੀ ਦੇ ਨਾਲ ਨਾਚ ਕਰਦੇ ਦੇਖੇ ਜਾ ਸਕਦੇ ਹਨ ਤਾਂ ਇਹ ਅ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤੀ ਸੰਗੀਤ ਜਿਹੜਾ ਦੁਨੀਆ ਭਰ ਦੇ ਵਿੱਚ ਆਪਣਾ ਇੱਕ ਅ ਪ੍ਰਮੁੱਖਤਾ ਦੇ ਨਾਲ ਇੱਕ ਵੱਡਾ ਸਥਾਨ ਰੱਖਦਾ ਹੈ ਅਗਰ ਅਸੀਂ ਫਿਲਮਾਂ ਬਾਰੇ ਗੱਲ ਕਰੀਏ ਤਾਂ ਅੱਜ ਕੱਲ੍ਹ ਪੰਜਾਬੀ ਸਿਨੇਮਾ ਦੇ ਵਿੱਚ ਭਾਰਤ ਦੇ ਵਿੱਚ ਜੋ ਪੰਜਾਬੀ ਸਿਨੇਮਾ ਚੱਲ ਰਿਹਾ ਉਹਦੇ ਵਿੱਚ ਮੁੱਖ ਤੌਰ 'ਤੇ ਕਮੋ ਕਮੇਡੀ ਦੇ ਨਾਲ ਸੰਬੰਧਿਤ ਹਾਸੇ ਨਾਲ ਸੰਬੰਧਿਤ ਫਿਲਮਾਂ ਦੀ ਬਹੁਤ ਭਰਮਾਰ ਹੈ ਪਰੰਤੂ ਇਸ ਦੇ ਵਿੱਚ ਸਾਨੂੰ ਕੁਝ ਕੁ ਫਿਲਮਾਂ ਇਸ ਤਰ੍ਹਾਂ ਦੀਆਂ ਵੀ ਮਿਲ ਜਾਂਦੀਆਂ ਹਨ ਜੋ ਕਿ ਸਮਾਜ ਨੂੰ ਇੱਕ ਸੇਧ ਅਤੇ ਮੈਸੇਜ ਦੇਣ ਵਾਲੀਆਂ ਸੰਦੇ ਚੰਗਾ ਸੰਦੇਸ਼ ਦੇਣ ਵਾਲੀਆਂ ਹੁੰਦੀਆਂ ਹਨ

ਅਤੇ ਅਦਾ ਅਭਿਨੇਤਰੀਆਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਇੱਕ ਚੰਗੀ ਅਭਿਨੇਤਰੀ ਦੇ ਤੌਰ 'ਤੇ ਉੱਭਰੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਅਭਿਨੇਤਰੀਆਂ ਹਨ ਪ੍ਰੰਤੂ ਉਸ ਦੀ ਜੋ ਅਦਾਇਗੀ ਹੈ ਜੋ ਉਸਦੀ ਐਕਟਿੰਗ ਹੈ ਉਹ ਕਾਫੀ ਮਚਿਓਰ ਕਿਸਮ ਦੀ ਅਤੇ ਚੰਗੀ ਕਿਸਮ ਦੀ ਐਕਟਿੰਗ ਹੈ ਗੀਤਾਂ ਦੀ ਗੱਲ ਕਰੀਏ ਅੱਜ ਕੱਲ੍ਹ ਜੋ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਵੀ ਹਨ ਉਹਨਾਂ ਵਿੱਚ ਵੀ ਸਾਨੂੰ ਪੰਜਾਬੀ ਮਿਊਜਿਕ ਪੰਜਾਬੀ ਸੰਗੀਤ ਬਹੁਤ ਪ੍ਰਮੁੱਖਤਾ ਦੇ ਨਾਲ ਅਸੀਂ ਸ ਸੁਣਦੇ ਹਾਂ ਜਿਵੇਂ ਕਿ ਹੁਣੇ ਆਈ ਇੱਕ ਅ ਫਿਲਮ ਐਨੀਮਲ ਦੇ ਵਿੱਚ ਸਾਨੂੰ ਇੱਕ ਪਰੰਪਰਾਗਤ ਪੰਜਾਬੀ ਅ ਸੰਗੀਤ ਨੂੰ ਸੁਣਨ ਦਾ ਆਨੰਦ ਆਨੰਦ ਮਾਣਿਆ ਅਸੀਂ ਸਾਰੇ ਸਾਰਿਆਂ ਨੇ ਜਿਹਦੇ ਵਿੱਚ ਅਰਜਨ ਵੈਲੀ ਨਾਮਕ ਇੱਕ ਸੌਂਗ ਇੱਕ ਗੀਤ ਬਹੁਤ ਹੀ ਮਸ਼ਹੂਰ ਹੋਇਆ ਜਿਹੜਾ ਕਿ ਬੱਬਲ ਨਾਮਕ ਪੰਜਾਬੀ ਗਾਇਕ ਵੱਲੋਂ ਗਾਇਆ ਗਿਆ ਸੀ ਸੋ ਇਸ ਸਬੰਧੀ ਮੈਂ ਇਹੀ ਕਹਿ ਸਕਦਾ ਹਾਂ ਕਿ ਭਾਰਤੀ ਸੰਗੀਤ ਅਤੇ ਭਾਰਤੀ ਫਿਲਮਾਂ ਦੁਨੀਆ ਵਿੱਚ ਆਪਣੇ ਨਵੇਕਲੇ ਅੰਦਾਜ਼ ਆਪਣੀਆਂ ਸੱਭਿਆਚਾਰਕ ਰੀਤੀ ਰਿਵਾਜ਼ਾਂ ਕਰਕੇ ਅਤੇ ਪਰਿਵਾਰ ਨੂੰ ਪ੍ਰਮੁੱਖਤਾ ਨਾਲ ਦਿਖਾਉਣ ਕਰਕੇ ਦੁਨੀਆ ਭਰ ਵਿੱਚ ਇਹ ਛਾਈਆਂ ਹੋਈਆਂ ਹਨ ਧੰਨਵਾਦ ਜੀ